ਹੈਲੋ ਬਾਈ ਤੁਸੀਂ ਗੁਰੂ ਨਾਨਕ ਏਜੰਸੀ ਚੋਂ ਬੋਲਦੇ ਹੋ ਮੈਂ ਪਹਿਲਾਂ ਵੀ ਤੁਹਾਡਾ ਗਾਹਕ ਹਾਂ ਪਹਿਲਾਂ ਵੀ ਆਪਾਂ ਬਹੁਤ ਵਾਰੀ ਯਾਤਰਾ 'ਤੇ ਗਏ ਹਾਂ ਅਤੇ ਇਸ ਵਾਰ ਆਪਾਂ ਫਿਰ ਵੀ ਯਾਤਰਾ 'ਤੇ ਜਾਣਾ ਹੈ ਪਰਿਵਾਰ ਦੇ ਨਾਲ ਦੋਸਤ ਮਿੱਤਰ ਵੀ ਹੈ ਅਤੇ ਹੁਣ ਮੈਨੂੰ ਇਹ ਦੱਸੋ ਵੀ ਆਪਾਂ ਯਾਤਰਾ 'ਤੇ ਜਾਣਾ ਵੀ ਤੁਸੀਂ ਕੈਸ ਲਉਂਗੇ ਦਸ ਕੁ ਦਿਨਾਂ ਵਾਸਤੇ ਜਾਣਾ ਵੀ ਕੈਸ ਲਉਂਗੇ ਜਾਂ ਪੇਮੇਂਟ ਗੂਗਲ ਪੇ ਰਾਹੀਂ ਕਰਾਂ ਜਾਂ ਪੇਟੀਐਮ ਕਰਾਂ ਜੇ ਕੈਸ ਲਉਂਗੇ ਤਾਂ ਕਿੰਨਾ ਲਉਂਗੇ ਜੇ ਗੂਗਲ ਪੇ ਕਰਾਂ ਤਾਂ ਕਿੰਨਾ ਕੈਸ ਦਸ ਹਜ਼ਾਰ ਰੁਪਏ ਆ ਜੀ ਗੂਗਲ ਪੇ ਗੁਗਲ ਪੇ ਦਾ ਇੱਦਾਂ ਕਰ ਵੀ ਆਪਾਂ ਹਰ ਵਾਰ ਜਾਂਦੇ ਹਾਂ ਇਕੱਠੇ ਵੀ ਯਾਰ ਤੂੰ ਘੱਟ ਕਰ ਲਾ ਆਪਾਂ ਤੇਰੇ ਪੱਕੇ ਗਾਹਕ ਹਾਂ ਨਾ ਯਾਰ ਬਾਈ ਘੱਟ ਕਰ ਨਾ ਐਂ ਨਾ ਕਰ ਵੀ ਤੈਨੂੰ ਪਤਾ ਜ਼ਿਆਦਾ ਅਤੇ ਬਾਕੀ ਪੱਕੇ ਗਾਹਕ ਹਾਂ ਤੇਰੇ ਜਾਂਦੇ ਰਹਿੰਦੇ ਹਾਂ ਹਰ ਵਾਰੀ ਦੋਸਤ ਮਿੱਤਰਾਂ ਨੇ ਜਾਣਾ ਚਲ ਐਂ ਕਰ ਫਿਰ ਪਚਾਨਵੇਂ ਸੌ ਰੁਪਏ ਲੈ ਲਈ ਨਹੀਂ ਨਹੀਂ ਨਹੀਂ ਨਾ ਨਾ ਮਾਲਕ ਨੂੰ ਨਹੀਂ ਨਹੀਂ ਆ ਫਿਰ ਵੀ ਪੱਕੇ ਆ ਕੰਮ ਚੱਲ ਪਚਾਨਵੇਂ ਸੌ

ਬਣਨੀ ਨਹੀਂ ਗੱਲ ਨਹੀਂ ਯਾਰ ਫਿਰ ਵੀ ਐਂ ਨਾ ਕਰ ਕੋਈ ਨਹੀਂ ਆਪਾਂ ਹਰ ਵਾਰ ਜਾਂਦੇ ਰਹਿੰਦੇ ਹਾਂ ਇਸ ਵਾਰ ਕਰ ਲਈ ਚਲ ਪਚਾਨਵੇਂ ਸੌ ਰੁਪਏ ਬਹੁਤ ਹੈ ਚਲ ਐਂ ਕਰ ਫਿਰ ਸੌ ਰੁਪਏ ਆਪਾਂ ਹੋਰ ਵਧਾ ਦੇਵਾਂਗੇ